ਸਤਿ ਸ਼੍ਰੀ ਅਕਾਲ ਜੀ ਮੈਂ ਮਹੀਨਾ ਪਹਿਲਾਂ ਇੱਕ ਪ੍ਰੈੱਸ ਔਡਰ ਕਰਵਾਈ ਸੀਗੀ ਤੁਹਾਡੇ ਤੋਂ ਅਤੇ ਉਹ ਪ੍ਰੈੱਸ ਮੈਨੂੰ ਬਿਲਕੁਲ ਟਾਈਮ 'ਤੇ ਮਿਲ ਗਈ ਡਿਲੀਵਰੀ ਬੋਆਏ ਵੀ ਬਿਲਕੁਲ ਟਾਈਮ 'ਤੇ ਆਇਆ ਅਤੇ ਉਹਨੇ ਸਾਡੇ ਤੋਂ ਕੋਈ ਐਕਸਟਰਾ ਚਾਰਜਸ ਨਹੀਂ ਲਏ ਅਤੇ ਜਦੋਂ ਮੈਂ ਪ੍ਰੈੱਸ ਦਾ ਬੋਕਸ ਦੇਖਿਆ ਤਾਂ ਮੈਨੂੰ ਬਹੁਤ ਜਿਆਦਾ ਐਕਸਾਈਟਮੈਂਟ ਹੋਈ ਕਿਉਂਕਿ ਇਸਦੀ ਪੈਕਿੰਗ ਹੀ ਬਹੁਤ ਜਿਆਦਾ ਵਧੀਆ ਸੀ ਪੈਕਿੰਗ ਦੇਖ ਕੇ ਮੈਨੂੰ ਇੱਦਾਂ ਲੱਗਿਆ ਵੀ ਪਤਾ ਨਹੀਂ ਕੀ ਕੀਮਤੀ ਚੀਜ਼ ਹੋਵੇਗੀ ਵਿੱਚ ਅਤੇ ਜਦੋਂ ਮੈਂ ਪ੍ਰੈੱਸ ਯੂਜ਼ ਕਰਨ ਲੱਗੀ ਤਾਂ ਜਦੋਂ ਇਹਨੂੰ ਖੋਲ੍ਹ ਕੇ ਦੇਖਿਆ ਤਾਂ ਹਰ ਇੱਕ ਚੀਜ਼ ਆਪਣੀ ਸਹੀ ਤਰੀਕੇ ਨਾਲ਼ ਰੱਖੀ ਹੋਈ ਸੀ ਜਦੋਂ ਖੋਲ੍ਹ ਕੇ ਦੇਖਿਆ ਪ੍ਰੈੱਸ ਨੂੰ ਬਹੁਤ ਵਧੀਆ ਪ੍ਰੈੱਸ ਸੀਗੀ ਅਤੇ ਜਿਹੜਾ ਕਲਰ ਅਸੀਂ ਚੂਜ਼ ਕੀਤਾ ਸੀਗਾ ਉਸ ਸੇਮ ਕਲਰ ਦੀ ਪ੍ਰੈੱਸ ਸਾਡੇ ਕੋਲ ਪਹੁੰਚੀ ਹੈ ਅਤੇ ਜਦੋਂ ਅਸੀਂ ਦੇਖਿਆ ਯੂਜ਼ ਕਰਕੇ ਜਦੋਂ ਲਾ ਕੇ ਦੇਖਿਆ ਤਾਂ ਇਹ ਬਹੁਤ ਛੇਤੀ ਗਰਮ ਹੋ ਜਾਂਦੀ ਅਤੇ ਕੱਪੜੇ ਪ੍ਰੈੱਸ ਕਰਕੇ ਦੇਖੇ ਤਾਂ ਕੱਪੜੇ ਵੀ ਬਿਲਕੁਲ ਸਹੀ ਤਰੀਕੇ ਨਾਲ਼ ਪ੍ਰੈੱਸ ਹੋਏ ਅਤੇ ਇਹ ਠੰਡੀ ਵੀ ਬਹੁਤ ਛੇਤੀ ਹੋ ਜਾਂਦੀ ਅਤੇ ਜਿਹੜੀ ਇਸਦੀ ਵਾਇਰ ਹੈ ਉਹ ਬਹੁਤ ਜਿਆਦਾ ਵਧੀਆ ਕੁਆਲਿਟੀ ਦੀ ਹੈ ਉਹਦੇ ਨਾਲ ਮਤਲਬ ਜਿਵੇਂ ਬੱਚੇ ਖੇਡਦੇ ਰਹਿੰਦੇ ਉਹਨਾਂ ਨੂੰ ਕਰੰਟ ਲੱਗਣ ਦਾ ਵੀ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਪ੍ਰੈੱਸ ਬਹੁਤ ਛੇ ਜਿਆਦਾ ਛੇਤੀ ਠੰਡੀ ਹੋ ਜਾਂਦੀ ਹੈ ਅਤੇ ਕੁਆਲਿਟੀ ਬਹੁਤ ਜਿਆਦਾ ਵਧੀਆ ਏ ਪ੍ਰੈੱਸ ਦੀ ਅਤੇ ਜ ਇੱਕ ਇਹਦੀ ਮੇਨ ਗੱਲ ਇਹ ਵੀ ਹੈ ਕਿ ਇਹਦਾ ਜਿਹੜਾ ਪ੍ਰਾਈਜ਼ ਹੈ ਮਾਰਕਿਟ ਨਾਲੋਂ ਬਹੁਤ ਜਿਆਦਾ ਸਸਤਾ ਪੈ ਗਿਆ ਅਤੇ ਜਿਹੜੀ ਬਿਜਲੀ ਦੀ ਖੱਪਤ ਹੈ ਉਹ ਵੀ ਬਹੁਤ ਜਿਆਦਾ ਘੱਟ ਹੁੰਦੀ ਹੈ ਅਤੇ ਜਿਹੜੇ ਸਾਡੇ ਗੁਆਂਢੀ ਉਹਨਾਂ ਨੇ ਵੀ ਦੇਖੀ ਉਹ ਵੀ ਕਹਿੰਦੇ ਵੀ ਬਹੁਤ ਵਧੀਆ ਪ੍ਰੈੱਸ ਹੈ ਅਸੀਂ ਉਹਨਾਂ ਲਈ ਵੀ ਦੋ ਤਿੰਨ ਪ੍ਰੈੱਸਾਂ ਔਡਰ ਕੀਤੀਆਂ ਅਤੇ ਅਸੀਂ ਅੱਗੇ ਨੂੰ ਵੀ ਇਹ ਤੁਹਾਡੀ ਹੋਰ ਇਲੈਕਟ੍ਰੋਨਿਕਸ ਦਾ ਸਮਾਨ ਮੰਗਵਾਉਂਦੇ ਰਹਾਂਗੇ ਧੰਨਵਾਦ ਜੀ